ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੈਬ ਸਰਵਿਸ ਅ ਵਿੱਚੋਂ ਕੈਬ ਬੁੱਕ ਕੀਤੀ ਸੀ ਜੋ ਕਿ ਸਮੇਂ ਦੇ ਵਿੱਚ ਮੇਰੇ ਕੋਲ ਨਹੀਂ ਪਹੁੰਚੀ ਮੈਂ ਦੋ ਘੰਟੇ ਪਹਿਲਾਂ ਇਹ ਕੈਬ ਬੁੱਕ ਕੀਤੀ ਸੀ ਅਤੇ ਹੁਣ ਮੈਂ ਇਸਨੂੰ ਕੈਂਸਲ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਮੈਂ ਇੱਕ ਹੋਰ ਕੈਬ ਬੁੱਕ ਕਰ ਲਈ ਹੈ ਜੋ ਕਿ ਪੰਜ ਦਸ ਮਿੰਟ ਦੇ ਵਿੱਚ ਮੇਰੇ ਕੋਲ ਆ ਰਹੀ ਹੈ